ਸਾਈਕਲ ਦੀ ਦੇਖਭਾਲ ਕਰਨ ਲਈ ਮੈਂ ਵੱਖ ਵੱਖ ਚੀਜ਼ਾਂ ਧਿਆਨ ਵਿੱਚ ਰੱਖਦਾ ਹਾਂ ਸਾਈਕਲ ਦੇ ਟਾਇਰਾਂ ਨੂੰ ਸਮੇਂ ਸਮੇਂ 'ਤੇ ਚੈੱਕ ਕਰਨ ਅਤੇ ਉਹਨਾਂ ਦੀ ਉਹਨਾਂ ਨੂੰ ਸਹੀ ਤਨਾਓ ਵਿੱਚ ਰੱਖਣਾ ਜ਼ਰੂਰੀ ਹੈ ਨਾਲ ਹੀ ਚੈਨ ਅਤੇ ਗ੍ਰੇਸ ਦੀ ਸਫਾਈ ਸਾਫ਼ ਸਫਾਈ ਅਤੇ ਚੀਲੀਆਂ ਦੀ ਗਰੀਸ ਲਗਾਉਣ ਦੀ ਵੀ ਮਹੱਤਵਪੂਰਨ ਹੈ ਵਾਇਰ ਦੀ ਕਰਕੇ ਬਰੇਕਸ ਦੀ ਕੁਸ਼ਲਤਾ ਵੀ ਯਕੀਨ ਬਣਾਉਣਾ ਜ਼ਰੂਰੀ ਹੈ ਤਾਂ ਜੋ ਸੁ ਸੁਰੱਖਿਆ ਜਾਰੀ ਰਹੇ ਸਾਈਕਲ ਚਲਾਉਣ ਲਈ ਚਲਾਉਣ ਲਈ ਸਾਈਕਲ ਚਲਾਉਣਾ ਕਈ ਵਾਰ ਥਕਾਵਟ ਵਾਲਾ ਥਕਾਵਟ ਵਾਲਾ ਹੋ ਸਕਦਾ ਹੈ ਖ਼ਾਸ ਕਰਕੇ ਜਦੋਂ ਲੰਬੇ ਰੂਟ 'ਤੇ ਜਾ ਰਿਹਾ ਹੋ ਉਹ ਇਸਦੇ ਲਈ ਤਾਜ਼ਗੀ ਬਣਾਈ ਰੱਖਣ ਲਈ ਰੁਕਾਵਟ ਅਤੇ ਚੰਗੀ ਰੀਹਾਈਡ੍ਰੇਸ਼ਨ ਅਤੇ ਠੰਡਾ ਪਾਣੀ ਪੀਣਾ ਜ਼ਰੂਰੀ ਹੈ ਜੇ ਲੰਬੇ ਰੂਟ 'ਤੇ ਜਾ ਰਹੇ ਹਾਂ ਤਾਂ ਆਪਣੀ ਸਿਹਤ ਅ ਸਾਈਕਲ ਦੀ ਸਥਿਤੀ ਧਿਆਨ ਰੱਖਣਾ ਤੋਂ ਬਾਅਦ ਵਿੱਚ ਖਾਣ ਪੀਣ ਅਤੇ ਆਰਾਮ ਕਰਨਾ ਸਹੀ ਲੰਬੇ ਰੂਟ 'ਤੇ ਸੁਚੇਤ ਅਤੇ ਪਰੇਤ ਪ੍ਰੇਰਿਤ ਰਹਿਣ ਲਈ ਮੈਂ ਹਮੇਸ਼ਾ ਆਪਣੇ ਮਨ ਵਿੱਚ ਮਨ ਵਿੱਚ ਇੱਕ ਟਾਰਗੇਟ ਰੱਖਦਾ ਹਾਂ ਤਾਂ ਜਿਵੇਂ ਕਿ ਆਪਣੇ ਆਖਰੀ ਗੰਥਾਂ ਤੱਕ ਪਹੁੰਚਣ ਜਾਂ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰੇਰਿਤ ਕਰਨ ਕਿ ਹਰ ਰੁਕਾਵਟ ਤੋਂ ਬਾਅਦ ਇੱਕ ਨਵਾਂ ਉਤਸ਼ਾਹ ਮਿਲਦਾ